ਤਿੰਨ ਅਕਤੂਬਰ ਉੱਨੀ ਸੌ ਤਰਾਨਵੇਂ ਇੱਕੀ ਅਕਤੂਬਰ ਉੱਨੀ ਸੌ ਅਠਾਨਵੇਂ ਦੋ ਜਨਵਰੀ ਦੋ ਹਜ਼ਾਰ ਪੰਜ ਸੱਤ ਅਗਸਤ ਉੱਨੀ ਸੌ ਅੱਸੀ ਦਸ ਅਪ੍ਰੈਲ ਦੋ ਹਜ਼ਾਰ ਅੱਠ